ਮੈਂ ਆਪਣੇ ਗੇਮ ਬਾਕਸ 'ਤੇ ਵਰਚੁਅਲ ਰਿਐਲਿਟੀ ਗੇਮ ਫੁੱਟਬਾਲ ਖੇਡੀ ਸੀ ਜੋ ਕਿ ਮੈਨੂੰ ਬਹੁਤ ਵਧੀਆ ਲੱਗੀ ਇਸ ਵਿੱਚ ਜਿਵੇਂ ਵੀ ਅਸੀਂ ਸਾਨੂੰ ਐਵੇਂ ਲੱਗਦਾ ਹੈ ਕਿ ਅਸੀਂ ਖੁਦ ਹੀ ਗੇਮ ਖੇਡ ਰਹੇ ਹਾਂ ਜਿਹੜੇ ਕਿ ਉਹ ਖਿਲਾੜੀ ਜਦਕਿ ਉਹ ਵਰਚੁਅਲ ਹੁੰਦੇ ਹਨ ਅਤੇ ਤੁਹਾਨੂੰ ਉਹਨਾਂ ਦੇ ਵਿੱਚ ਜਦੋਂ ਵੀ ਤੁਸੀਂ ਜਿੱਤਦੇ ਹੋ ਤੁਹਾਨੂੰ ਐਵੇਂ ਲੱਗਦਾ ਹੈ ਜਿਵੇਂ ਕਿ ਤੁਸੀਂ ਅਸਲ ਜ਼ਿੰਦਗੀ ਵਿੱਚ ਜਿੱਤੇ ਹੋ